ਪੰਜਾਬ ਵਿੱਚ ਕਾਰੋਬਾਰੀ ਮਾਹੌਲ ਅਤੇ ਨਵੀਨਤਾ ਲਈ ਸਾਨੂੰ ਕਈ ਕਦਮ ਚੁੱਕਣੇ ਚਾਈਦੇ ਹਨ ਉਨ੍ਹਾਂ ਵਿੱਚੋਂ ਸਾਨੂੰ ਇਹ ਦੇਖਣਾ ਚਾਈਦਾ ਹੈ ਕਿ ਜਿਵੇਂ ਕੀ ਬਾਹਰ ਦੀਆਂ ਕੰਪਨੀਆਂ ਪੰਜਾਬ 'ਚ ਆ ਕੇ ਵੀ ਆਪਣਾ ਬਿਜਨਸ ਸਥਾਪਿਤ ਕਰੇ ਕਈ ਜ ਤਰ੍ਹਾਂ ਦੇ ਸੈਮੀਨਾਰ ਲਗਾਵੇ ਕਈ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰੇ ਤਾਂ ਕੀ ਪੰਜਾਬ ਦੇ ਲੋਕਾਂ ਨੂੰ ਨਵੀਨਤਾ ਦਾ ਅਹਿਸਾਸ ਹੋਵੇ ਅਤੇ ਉਹ ਵੀ ਉਸ ਤਰੀਕੇ ਨਾਲ ਹੀ ਆਪਣੇ ਆਪ ਨੂੰ ਅੱਗੇ ਵਧਾਵੇ ਕਈ ਥਾਵਾਂ ਤੇ ਬਾਹਰਲੀਆਂ ਕੰਪਨੀਆਂ ਆਪਣਾ ਬਿਜਨਸ ਐਨਾ ਕ ਪ੍ਰਮੋਟ ਕਰ ਦਿੰਦੀਆਂ ਹਨ ਕੀ ਉਹ ਰਾਜਯ ਜਾਂ ਉਹ ਦੇਸ਼ ਬਹੁਤ ਅੱਗੇ ਵੱਧ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਨੂੰ ਵੀ ਇਸ ਚੀਜ ਦੀ ਲੋੜ ਐ ਬਾਹਰਦੀਆਂ ਕੰਪਨੀਆਂ ਦਾ ਸਾਡੇ ਪੰਜਾਬ 'ਚ ਆ ਕੇ ਕੰਮ ਕਰਨਾ ਪੰਜਾਬ ਨੂੰ ਅੱਗੇ ਵਧਾਉਣ ਲੀਏ ਇੱਕ ਬੜਾ ਅੱਛਾ ਤਰੀਕਾ ਹੈ ਅਤੇ ਇਨ੍ਹਾਂ ਨਾਲ ਕੀ ਹੋਏਗਾ ਕੀ ਅਸੀਂ ਜਦੋਂ ਵੱਧ ਤੋਂ ਵੱਧ ਪ੍ਰੋਗਰਾਮ ਲਗਾਵਾਂਗੇ ਸੈਮੀਨਾਰ ਕਰਾਵਾਂਗੇ ਉਨ੍ਹਾਂ ਵਿੱਚ ਲੋਕਾਂ ਨੂੰ ਉਤੇਜਿਤ ਕਰਾਂਗੇ ਕੀ ਉਹ ਵੀ ਅੱਗੇ ਹੋ ਕੇ ਇਸ ਚੀਜਾਂ ਨੂੰ ਅਪਨਾਣ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਹੋਰ ਅੱਗੇ ਲੈ ਕੇ ਜਾਣ